ਸਤਿ ਸ਼੍ਰੀ ਅਕਾਲ ਮੈਂ ਕੱਲ੍ਹ ਤੁਹਾਡੀ ਕੰਪਨੀ ਤੋਂ ਇੱਕ ਡਿਜੀਟਲ ਘੜੀ ਆਡਰ ਕੀਤੀ ਸੀ ਜਿਸਦੀ ਪੇਮੈਂਟ ਔਨਲਾਈਨ ਮਾਧਿਅਮ ਰਾਹੀਂ ਭਰ ਦਿੱਤੀ ਗਈ ਸੀ ਪਰ ਮੇਰੇ ਚਾਚਾ ਜੀ ਨੇ ਇੱਕ ਅਜਿਹੀ ਹੀ ਘੜੀ ਮੈਨੂੰ ਤੋਹਫੇ ਵਜੋਂ ਭੇਜ ਦਿੱਤੀ ਹੈ ਇਸ ਲਈ ਮੈਨੂੰ ਇਹ ਆਡਰ ਰੱਦ ਕਰਨਾ ਪੈ ਰਿਹਾ ਹੈ ਇਸ ਘੜੀ ਦਾ ਆਡਰ ਨੰਬਰ ਪੰਜ ਤਿੰਨ ਇੱਕ ਚਾਰ ਪੰਜ ਸੱਤ ਅੱਠ ਨੌ ਸੱਤ ਛੇ ਹੈ ਜਿਸ ਨੂੰ ਮੈਂ ਗੂਗਲ ਪੇਅ ਦੇ ਮਾਧਿਅਮ ਰਾਹੀਂ ਭੁਗਤਾਨ ਕਰਕੇ ਮੰਗਵਾਇਆ ਸੀ ਕਿਰਪਾ ਕਰਕੇ ਮੈਨੂੰ ਰੱਦ ਕੀਤੇ ਆਡਰ ਦਾ ਰਿਫੰਡ ਮੇਰੇ ਆਡਰ ਕੀਤੇ ਗਏ ਮੋਬਾਇਲ ਨੰਬਰ ਉੱਤੇ ਹੀ ਕੀਤਾ ਜਾਵੇ ਧੰਨਵਾਦ